ਸਤਿ ਸ਼੍ਰੀ ਅਕਾਲ ਜੀ ਤਰਨ ਤਾਰਨ ਸਾਹਿਬ ਅੰਮ੍ਰਿਤਸਰ ਤੋਂ ਬਾਈ ਕਿਲੋਮੀਟਰ ਦੂਰ ਵਸਿਆ ਹੋਇਆ ਹੈ ਅਤੇ ਇਹ ਪੰਜਵੇਂ ਗੁਰੂ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਸਾਇਆ ਸੀ ਅਤੇ ਇੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਅਤੇ ਉੱਥੋਂ ਦਾ ਸਰੋਵਰ ਬਹੁਤ ਹੀ ਵੱਡਾ ਸਰੋਵਰ ਗਿਣਿਆ ਜਾਂਦਾ ਹੈ ਇੱਥੋਂ ਦੀ ਸਭ ਤੋਂ ਮਸ਼ਹੂਰ ਚੀਜ਼ ਹੈ ਸੁਰਮਾ ਇਹ ਇਹ ਗੋਇੰਦਵਾਲ ਸਾਹਿਬ ਪ ਸੁਰਮਾ ਮਿਲਦਾ ਜੋ ਕਿ ਅੱਖਾਂ ਲਈ ਬਹੁਤ ਹੀ ਵਧੀਆ ਹੁੰਦਾ ਹੈ ਉਹ ਪੁਰਾਤਨ ਤਰੀਕੇ ਨਾਲ ਬਣਿਆ ਹੋਇਆ ਸੁਰਮਾ ਹੁੰਦਾ ਹੈ ਅਤੇ ਅੱਜ ਵੀ ਪੀੜੀ ਦਰ ਪੀੜੀ ਉੱਥੇ ਇਹ ਮਨਾਇਆ ਜਾ ਰਿਹਾ ਹੈ ਅਤੇ ਅੱਗੇ ਚੱਲ ਰਿਹਾ ਹੈ ਬਾਕੀ ਜੋ ਵੀ ਆ ਜਿਵੇਂ ਸੇਮ ਟੂ ਸੇਮ ਅਸੀਂ ਲਾ ਲਈਏ ਕਿ ਅੰਮ੍ਰਿਤਸਰ ਵਿੱਚ ਜਿਵੇਂ ਪੰਜਾਬੀ ਜੁੱਤੀ ਮਸ਼ਹੂਰ ਆ ਉਵੇਂ ਹੀ ਤਰਨ ਤਾਰਨ ਵਿੱਚ ਵੀ ਪੰਜਾਬੀ ਜੁੱਤੀ ਪਾਪੜ ਵੜੀਆਂ ਇੱਦਾਂ ਦੇ ਕੰਮ ਹੀ ਮਸ਼ਹੂਰ ਹਨ ਹੋਰ ਤਰਨ ਤਾਰਨ ਸਾਹਿਬ ਵਿੱਚ ਲਾਗੇ ਹਰੀਕੇ ਪੱਤਣ ਹੈ ਜਿੱਥੇ ਕਰਕੇ ਉੱਥੇ ਵਿਦੇਸ਼ੀ ਪੰਛੀ ਆਉਂਦੇ ਹਨ ਅਤੇ ਉਹ ਮੱਛੀ ਪਾਲਣ ਦਾ ਉੱਥੇ ਕੰਮ ਵੀ ਹੁੰਦਾ ਹੈ ਉਹ ਬਹੁਤ ਮਸ਼ਹੂਰ ਹੈ ਅਤੇ ਬਾਕੀ ਉੱਥੇ ਜੋ ਹੈ ਖੇਤੀਬਾੜੀ ਇੱਕ ਮੁੱਖ ਕਿੱਤਾ ਹੈ ਜੋ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ ਅਤੇ ਅੱਗੇ ਵੀ ਚੱਲ ਚੱਲ ਹੀ ਰਿਹਾ ਵਾ ਉੱਥੇ ਖੇਤੀ ਆ ਜਿਵੇਂ ਝੋਨਾ ਫਸਲ ਉਗਾਈ ਜਾਂਦੀ ਹੈ ਇਹ ਇਸੇ ਤਰ੍ਹਾਂ ਫਸਲਾਂ ਸਮੇਂ ਦੇ ਨਾਲ ਦੋ ਸੀਜਨੀ ਬਹਾਰੀ ਫਸਲ ਬੀਜੀ ਜਾਂਦੀ ਹੈ ਇਸੇ ਕਰਕੇ ਮਸ਼ਹੂਰ ਹੈ ਬਾਕੀ ਤਰਨ ਤਾਰਨ ਜੋ ਅੰਮ੍ਰਿਤਸਰ ਸ਼ਹਿਰ 'ਚ ਮਸ਼ਹੂਰ ਹੈ ਉਹੀ ਉੱਥੇ ਵੀ ਚੀਜ਼ਾਂ ਮਸ਼ਹੂਰ ਹਨ ਕੋਈ ਖਾਸ ਫਰਕ ਨਹੀਂ ਹੈ ਕਿਉਂਕਿ ਉਹ ਸਿੱਖਾਂ ਦਾ ਹੀ ਹੀ ਸਥਾਨ ਹੈ ਸੀ ਇਸ ਕਰਕੇ ਉਹ ਰਲਦੀਆਂ ਮਿਲਦੀਆਂ ਚੀਜ਼ਾਂ ਹੀ ਉੱਥੇ ਵੀ ਹਨ ਸ਼ੁਕਰੀਆ